ਹਾਂਜੀ ਸਟਿਚਿੰਗ ਵਿੱਚ ਸਭ ਤੋਂ ਵੱਧ ਸ ਮਸ਼ੀਨੀ ਸਿਲਾਈ ਦਾ ਕੰਮ ਹੁੰਦਾ ਜਿਹਦਾ ਅੱਜ ਕੱਲ੍ਹ ਬਹੁਤ ਟਰੈਂਡ ਹੈ ਬਹੁਤ ਜ਼ਿਆਦਾ ਕੰਮ ਇਸ ਚੀਜ਼ ਦਾ ਆ ਰਿਹਾ ਹਰ ਤਰ੍ਹਾਂ ਦਾ ਕੱਪੜਾ ਹਰ ਤਰ੍ਹਾਂ ਦਾ ਡਿਜ਼ਾਈਨ ਹਰ ਤਰ੍ਹਾਂ ਦਾ ਡਿਜ਼ਾਇਨ ਯੂਜ ਹੁੰਦਾ ਹੈ ਮੈਂ ਉਹਦੇ ਵਿੱਚ ਸ਼ਰਾਰਾ ਗਰਾਰਾ ਲਹਿੰਗਾ ਸਿੰਪਲ ਸੂਟ ਪੰਜਾਬੀ ਸੂਟ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਣੀਆਂ ਪਸੰਦ ਕਰਦੀ ਹਾਂ ਜਿਹਦੇ ਵਿੱਚ ਅੱਜ ਕੱਲ੍ਹ ਜੋ ਸਾਰਿਆਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਚੱਲ ਰਿਹਾ ਕਰੋਸ਼ੀਏ ਦਾ ਕੰਮ ਸਿਲਾਈ ਦਾ ਕੰਮ ਅਤੇ ਕਰੋਸ਼ੀਏ ਦਾ ਕੰਮ ਇੱਕ ਆਰਟ ਨੂੰ ਵੀ ਪਰਫੋਰਮ ਕਰਦਾ ਹਾਂਜੀ ਸਟਿਚਿੰਗ ਦਾ ਕੰਮ ਸਿਲਾਈ ਦੇ ਕੰਮ ਵਿੱਚ ਜਿਹੜਾ ਕਿ ਸਰਦੀਆਂ ਦੇ ਕੰਮ ਵਿੱਚ ਕਰੋਸ਼ੀਆ ਗਰਮੀ ਅਤੇ ਸਰਦੀ ਦੋਵਾਂ ਵਿੱਚ ਹੀ ਯੂਜ ਹੁੰਦਾ ਕਰੋਸ਼ੀਏ ਦਾ ਜਿਹੜਾ ਧਾਗਾ ਏ ਉਹਦੇ ਵਿੱਚ ਹਰ ਤਰ੍ਹਾਂ ਦਾ ਧਾਗਾ ਹੀ ਹੁੰਦਾ ਕਾਟਨ ਦਾ ਸੰਥੈਟਿਕ ਵੂਲਨ ਹਰ ਚੀਜ਼ ਨਾਲ ਉਹਨੂੰ ਬੜੀ ਸੋਹਣਾ ਡਿਜ਼ਾਈਨ ਕੀਤਾ ਜਾ ਸਕਦਾ ਕਰੋਸ਼ੀਏ ਦਾ ਕੰਮ ਅੱਜ ਦੇ ਟਾਈਮ ਵਿੱਚ ਵਾਪਸ ਬਹੁਤ ਪੁਰਾਣਾ ਕੰਮ ਹੈ ਜਿਹੜਾ ਅੱਜ ਦੁਬਾਰਾ ਵਾਪਸ ਡਿਜ਼ਾਇਨ ਕੀਤਾ ਜਾ ਰਿਹਾ ਜਿਹਦੇ ਵਿੱਚ ਬੜੀਆਂ ਅੱਛੀਆਂ ਅੱਛੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਜਿਹਨੂੰ ਸੂਟਾਂ 'ਤੇ ਸਰਦੀ ਦੇ ਵੂਲਨਸ ਚਾਦਰਾਂ ਟਬਲ ਮੈਟਸ ਹਰ ਤਰ੍ਹਾਂ ਦੇ ਚੀਜ਼ 'ਤੇ ਕਰੋਸ਼ੀਆ ਯੂਜ਼ ਕੀਤਾ ਜਾਂਦਾ ਅਤੇ ਇਹਦੇ ਵਿੱਚ ਹਰੇਕ ਦੀ ਪਸੰਦ ਏ ਬੱਚਿਆਂ ਦਾ ਕੰਮ ਵੱਡਿਆਂ ਦਾ ਕਿਸੇ ਵੀ ਕਿਸਮ ਦੀ ਚੀਜ਼ ਨੂੰ ਸਜਾਇਆ ਜਾ ਸਕਦਾ ਸਿਲਾਈਆਂ ਦਾ ਕੰਮ ਜਿਹੜਾ ਕਿ ਸਰਦੀਆਂ ਵਿੱਚ ਅੱਛੇ ਅੱਛੇ ਸਵੈਟਰ ਵੂਲਨਜ਼ ਬਹੁਤ ਅੱਛਾ ਚੀਜ਼ਾਂ ਬਣਦੀਆਂ ਨੇ ਅਤੇ ਹਰ ਇੱਕ ਤਰ੍ਹਾਂ ਦਾ ਕੱਪੜਾ ਤਿਆਰ ਕੀਤਾ ਜਾਂਦਾ ਉਹਦੇ ਨਾਲ ਥੈਂਕ ਯੂ